ਲੋਕ ਗੀਤ ਇਹ ਉਹ ਇਹ ਉਸ ਤਰ੍ਹਾਂ ਦੇ ਗੀਤ ਹੈ ਜਿਹੜੇ ਬਹੁਤ ਹੀ ਵਧੀਆ ਅਤੇ ਸੁਰੀਲੇ ਗੀਤ ਹੁੰਦੇ ਹਨ ਇਹ ਸਾਨੂੰ ਸਾਡੀ ਟਰੈਡੀਸ਼ਨਲ ਨਾਲ ਜੋੜਦੇ ਹਨ ਇਹ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਗੀਤ ਮੈਨੂੰ ਪਰਸਨਲੀ ਬਹੁਤ ਪਸੰਦ ਹਨ ਇਹ ਵਾਲੇ ਗੀਤ ਸਾਨੂੰ ਸਾਡੇ ਵਡ ਵੱਡੇ ਵਡੇਰਿਆਂ ਨਾਲ ਵੀ ਜੋੜਦੇ ਹਨ ਲੋਕ ਗੀਤ ਬਹੁਤ ਅੱਜ ਕੱਲ ਪ੍ਰਸਿੱਧ ਇਸ ਕਰਕੇ ਹੁੰਦੇ ਹਨ ਕਿਉਂਕਿ ਇਹ ਸਾਨੂੰ ਸਾਡੀ ਪੁਰਾਣੀ ਰਿਵਾਜ਼ ਅਤੇ ਨੀਤੀ ਸਾਨੂੰ ਦੱਸਦੇ ਹਨ ਸਾਡੇ ਸੰਸਕਾਰ ਸਾਡੇ ਮਾਪਿਆਂ ਦੇ ਸਾਡੇ ਬਜ਼ੁਰਗਾਂ ਉਹ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਦੇ ਹਨ ਉਹਨਾਂ ਦੀ ਜ਼ਿੰਦਗੀ ਕਿਵੇਂ ਹੁਣ ਹੁੰਦੀਆਂ ਸੀ ਗਾਵਾਂ ਦੀ ਸ਼ਹਿਰ ਦੀ ਅਤੇ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਜੇ ਜਿਹੜੀ ਅਸੀਂ ਆਜ ਤੱਕ ਦੇ ਅੱਜ ਕਲ੍ਹ ਦੇ ਨੌਜਵਾਨ ਨੇ ਕਦੇ ਦੇਖੀਆਂ ਵੀ ਨਹੀਂ ਹਨ ਲੋਕ ਗੀਤ ਬਹੁਤ ਹੀ ਵਧੀਆ ਹੁੰਦੇ ਹਨ ਇਹ ਮੈਨੂੰ ਬੇ ਬੇਸਿਕਲੀ ਸਾਨੂੰ ਪਸੰਦ ਹੈ ਲੋਕ ਗੀਤ ਗੁਰਦਾਸ ਮਾਨ ਜੀ ਦਾ ਗੁਰਜਾ ਗੁਰਦਾਸ ਮਾਨ ਨੇ ਬਹੁਤ ਹੀ ਵਧੀਆ ਆਪਣੇ ਟਾਈਮ ਦੇ ਸਿੰਗਰ ਰਹੇ ਸਨ ਜਿਨ੍ਹਾਂ ਨੇ ਫਿਲਮਾਂ ਦੇ ਨਾਲ ਨਾਲ ਲੋਕ ਗੀਤ ਵੀ ਬਥੇਰੇ ਗਾਏ ਹਨ ਲੋਕ ਗੀਤ ਦ ਲੋਕ ਗੀਤ ਦੇ ਵਿੱਚ ਮੈਂ ਕੁਛ ਲਾਈਨਾਂ ਪੇਸ਼ ਕਰਨੀਆਂ ਚਾਹੂੰਗਾ ਚਾਰ ਲਾਇਨਾ ਲੋਕ ਗੀਤ ਮਨ ਭਾਉਂਦੇ ਹੁੰਦੇ ਹਨ ਇਹ ਸਾਨੂੰ ਸਾਡੇ ਪੁਰਾਣੇ ਪੰਜਾਬ ਨਾਲ ਜੋੜਦੇ ਹਨ ਲੋਕ ਗੀਤਾਂ ਵਿੱਚ ਇੱਕ ਅਲਗ ਹੀ ਸੱਚਾਈ ਹੁੰਦੀ ਹੈ ਇਹਦੀ ਬੋਲੀ ਸਾਨੂੰ ਸਾਡੇ ਵੱਡੇ ਵਡੇਰਿਆਂ ਨਾਲ ਜੋੜਦੀ ਹੈ ਅਤੇ ਲਾਸਟ ਵਿੱਚ ਇੱਕ ਮੈਂ ਗੁਰਦਾਸ ਮਾਨ ਜੀ ਦਾ ਛੱਲਾ ਪਸੰਦ ਦੀ ਚਾਰ ਲੈਨਾ ਮੈਂ ਹੋ ਹੋਰ ਤੁਹਾਨੂੰ ਦਰਸਾਉਣੀ ਚਾਹੁੰਦਾ ਹਾਂ ਛੱਲਾਂ ਗੱਲ ਦੀ ਗਾਨੀ ਕਿੱਥੇ ਗਏ ਰੁੱਸੇ ਹੋਏ ਜਾਨੀ ਇੱਕ ਵਾਰ ਗਈ ਮੁੜ ਨਹੀਂ ਆਉਣੀ ਜਵਾਨੀ ਤੁਸੀਂ ਦੇਖੋ ਇਹ ਜ਼ਿੰਦਗੀ ਦੀ ਕਿੱਡੀ ਵੱਡੀ ਸੱਚਾਈ ਹੈ